ਹਾਂ ਬਿਲਕੁਲ ਮੈਂ ਇਸ ਵਿੱਚ ਵਿਸ਼ਵਾਸ ਰੱਖਦੀ ਹਾਂ ਕਿ ਟੀਵੀ ਅਤੇ ਆਨਲਾਈਨ 'ਤੇ ਵਧੇਰੇ ਮੁਫਤ ਵਿੱਦਿਅਕ ਸਮੱਗਰੀ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਬਿਹਤਰ ਵਿਕਾਸ ਹੋ ਹੋ ਸਕੇ ਕਿਉਂਕਿ ਅੱਜਕੱਲ੍ਹ ਦੀ ਸਕੂਲੀ ਸਿੱਖਿਆ ਓਨੀ ਨਹੀਂ ਹੈ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਅਤੇ ਅਧਿਆਪਕ ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਸਿਰਫ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਹੀ ਧਿਆਨ ਦਿੰਦੇ ਹਨ ਅਤੇ ਨਲਾਇਕ ਵਿਦਿਆਰਥੀ ਜਾਂ ਫਿਰ ਨਾ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਧਿਆਨ ਨਹੀਂ ਦਿੰਦੇ ਇਸ ਲਈ ਉਨ੍ਹਾਂ ਦਾ ਵਿਕਾਸ ਘੱਟ ਜਾਂਦਾ ਹੈ ਇਸ ਇਸ ਵਿੱਚ ਉਨ੍ਹਾਂ ਦੀ ਮਦਦ ਕੁਝ ਅਜਿਹੇ ਚੈਨਲ ਜੋ ਯੂਟਿਊਬ 'ਤੇ ਹੋ ਹਨ ਉਹ ਇਸ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਕੁਝ ਚੈਨਲ ਅਜਿਹੇ ਅਤੇ ਕੁਝ ਚੈਨਲ ਅਤੇ ਵੈੱਬਸਾਈਟਾਂ ਅਜਿਹੀਆਂ ਹਨ ਜਿਸ ਦੀ ਮੈਂ ਵੀ ਪਾਲਣਾ ਕਰਦੀ ਹਾਂ ਕਿਊਂਕਿ ਮੈਂ ਇੱਕ ਕਮਰਸ ਦੀ ਸਟੂਡੈਂਟ ਰਹਿ ਸਕ ਰਹਿ ਕਿਉਂਕਿ ਮੈਂ ਇੱਕ ਕਮਰਸ ਦੀ ਸਟੂਡੈਂਟ ਰਰੀ ਹਾਂ ਇਸ ਲਈ ਮੈਂਨੂੰ ਬਹੁਤ ਸਾਰੇ ਚੈਨਲਾਂ ਤੋਂ ਬਹੁਤ ਸਹਾਇਤਾ ਮਿਲਦੀ ਸੀ ਜਿਵੇਂ ਕਿ ਰਜਤ ਅਰੋੜਾ ਕਮਰਸ ਅੱਡਾ ਇਸ ਤੋਂ ਮੈਨੂੰ ਬਹੁਤ ਹੀ ਫਿਰ ਬਿਹਤਰ ਤਰੀਕੇ ਢੰਗ ਨਾਲ ਕੁਝ ਵੀ ਚੀਜ਼ ਹੱਲ ਕਰਨੀ ਦੱਸੀ ਜਾ ਜਾ ਰਹੀ ਸੀ ਇਸ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲੀ ਅਤੇ ਬਹੁਤ ਸੌਖਾ ਢੰਗ ਮਿਲਿਆ ਕੁਛ ਵੀ ਚੀਜ਼ ਕਰਨ ਦਾ ਅਤੇ ਇਸ ਨਾਲ ਮੇਰੇ ਪੇਪਰਾਂ ਵਿੱਚ ਵੀ ਬਹੁਤ ਸਹਾਇਤਾ ਹੋਈ ਅਤੇ ਮੈਂ ਆਪਣੇ ਪੇਪਰ ਬਹੁਤ ਹੀ ਆਰਾਮ ਨਾਲ ਅਤੇ ਵਧੀਆ ਕੀਤੇ